ਹੈਲੋ ਹੈਲੋ ਸਰ

ਯਕੀਨਨ ਸਰ ਤੁਸੀਂ ਕਿਹੜੀ ਕਾਰ ਚਾਹੁੰਦੇ ਹੋ ਯਕੀਨਨ ਸਰ ਅਸੀਂ ਪਹਿਲਾਂ ਡਿਜਾਇਰ 'ਤੇ ਨਜ਼ਰ ਮਾਰਾਂਗੇ ਇਹ ਇੱਕ ਸੈਡਾਨ ਕਾਰ ਹੈ ਤੁਹਾਨੂੰ ਕਿਹੜਾ ਮਾਡਲ ਚਾਹੀਦਾ ਹੈ ਯਕੀਨਨ ਇਸ ਵਿੱਚ ਤੁਹਾਨੂੰ ਹੈ ਨਾ ਪਾਰਕਿੰਗ ਸੈਂਸਰਾਂ ਵਾਲਾ ਇੱਕ ਡੈਸਕਲੋਪ ਮਿਲੇਗਾ ਅ ਤੁਹਾਨੂੰ ਅੱਗੇ ਅਤੇ ਪਿੱਛੇ ਦੋਵਾਂ ਪਾਸੇ ਪਾਵਰ ਵਿੰਡੋਜ ਵੀ ਮਿਲਣਗੀਆਂ ਇਸ ਦੀ ਔਨ ਰੋਡ ਕੀਮਤ ਅੱਠ ਲੱਖ ਹਜ਼ਾਰ ਹੋਵੇਗੀ ਹਾਂਜੀ ਸਿਆਜ਼ ਵਿੱਚ ਤੁਹਾਨੂੰ ਪਾਰਕਿੰਗ ਸੈਂਸਰ ਪਾਵਰ ਵਿੰਡੋ ਸਨ ਰੂਫ ਬੈਂਕ ਮਿਰਰ ਅਤੇ ਵਾਈਪਰ ਦੇ ਨਾਲ ਆਟੋ ਗੇਅਰ ਹੋਰ ਵੀ ਮਿਲਣਗੇ ਇਸ ਦੀ ਇਸ ਦਸ ਲੱਖ ਪੱਚੀ ਹਜ਼ਾਰ ਸਾਰੇ ਸਮਾਨ ਸਮੇਤ ਹੋਵੇਗੀ ਯਕੀਨਨ ਸਰ ਭੁਗਤਾਨ ਬਾਰੇ ਕਿਵੇਂ ਹਾਂਜੀ ਸਰ ਜੀ ਜ਼ਰੂਰ ਅਸੀਂ ਥੋੜ੍ਹੀ ਦੇਰ ਵਿੱਚ ਤੁਹਾਡੀ ਕਾਰ ਤਿਆਰ ਕਰਵਾ ਦੇਵਾਂਗੇ ਹਾਂਜੀ ਯਕੀਨਨ ਸਰ ਉਦੋਂ ਤੱਕ ਅਸੀਂ ਤੁਹਾਡੀ ਕਾਰ ਤਿਆਰ ਕਰ ਦਾਂਗੇ ਜੀ ਥੈਂਕ ਯੂ ਜੀ ਥੈਂਕ ਯੂ